ਸਤਿ ਸ੍ਰੀ ਅਕਾਲ ਸ਼੍ਰੀਮਾਨ ਜੀ ਮੈਂ ਤੁਹਾਡੀ ਦੁਕਾਨ ਤੋਂ ਪਹਿਲਾਂ ਇੱਕ ਪ੍ਰੋਡਕਟ ਮੰਗਾਇਆ ਸੀਗਾ ਜੋ ਕਿ ਠੀਕ ਸੀਗਾ ਉਹ ਤੌਲੀਏ ਮੰਗਵਾਏ ਸੀਗੇ ਇਹ ਤੋਲੀਏ ਵਧੀਆ ਸੀਗੇ ਰੰਗ ਵੀ ਵਧੀਆ ਸੀਗੇ ਸਭ ਕੁਛ ਉਹਨਾਂ ਦਾ ਵਧੀਆ ਸੀ ਉਹਨਾਂ ਦਾ ਕੱਪੜਾ ਵੀ ਵਧੀਆ ਸੀ ਪਰ ਜਦੋਂ ਮੈਂ ਤੁਹਾਡੇ ਕੋਲੋਂ ਦੂਸਰਾ ਪ੍ਰੋਡਕਟ ਮੰਗਾਇਆ ਹੈ ਉਹ ਸੂਟ ਮੰਗਵਾਏ ਸੀ ਲੇਡੀ ਸੂਟ ਉਹ ਸਾਰੇ ਸੂਟ ਜਿਹੜੇ ਸੀਗੇ ਉਹਨਾਂ ਦੇ ਵਿੱਚ ਡਿਫੈਕਟ ਸੀ ਕਈ ਸੂਟ ਜਿਹੜੇ ਸੀ ਉਹਨਾਂ ਦੇ ਰੰਗ ਫੇਡ ਸੀਗੇ ਕਈ ਸੂਟ ਇਸ ਤਰ੍ਹਾਂ ਦੇ ਸੀ ਜਿਨ੍ਹਾਂ ਦੀ ਕਢਾਈ ਠੀਕ ਨਹੀਂ ਸੀ ਤਾਂ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹੂੰਗੀ ਕਿ ਮੇਰਾ ਜਿਹੜਾ ਸੈਕਿੰਡ ਪ੍ਰੋਡਕਟ ਹੈ ਉਸਨੂੰ ਰਿਪਲੇਸ ਕੀਤਾ ਜਾਵੇ ਉਹਦੀ ਥਾਂ 'ਤੇ ਮੈਨੂੰ ਦੂਸਰਾ ਜਿਹੜਾ ਪ੍ਰੋਡਕਟ ਹੈ ਉਹ ਭੇਜਿਆ ਜਾਵੇ ਪਹਿਲਾਂ ਵਾਲਾ ਜਿਹੜਾ ਪ੍ਰੋਡਕਟ ਹੈ ਉਹ ਮੈਂ ਤੁਹਾਨੂੰ ਵਾਪਿਸ ਕਰ ਦਉਂਗੀ ਅਤੇ ਅੱਗੇ ਤੋਂ ਤੁਸੀਂ ਇਸ ਤਰ੍ਹਾਂ ਦੀ ਕੋਈ ਵੀ ਗਲਤੀ ਮੇਰੇ ਨਾਲ ਨਾ ਕਰਿਓ ਤਾਂ ਕਿ ਆਪਣਾ ਜਿਹੜੀਆਂ ਆਪਸ ਦੇ ਵਿੱਚ ਜਿਹੜਾ ਹੈ ਰਿਸ਼ਤਾ ਹੈ ਜਿਹੜੀਆਂ ਟਰਮਸ ਨੇ ਉਹ ਠੀਕ ਰਹਿ ਸਕਣ ਧੰਨਵਾਦ